ਮੋਹਾਲੀ ਜ਼ਿਲ੍ਹੇ ਵਿੱਚ ਸਿੱਖਿਆ ਬਹੁਤ ਹੱਦ ਤੱਕ ਠੀਕ ਹੈ ਪਰ ਇੱਥੋਂ ਦੀ ਸਿੱਖਿਆ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਖਿੱਚ ਪਾ ਰਹੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਫ਼ੀਸਾਂ ਬਹੁਤ ਜ਼ਿਆਦਾ ਹੋਣ ਦੇ ਕਾਰਨ ਕਈ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ ਅਤੇ ਦੂਜੇ ਹੱਥ ਸਰਕਾਰੀ ਸਕੂਲਾਂ ਦੀ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਹੀ ਹਾਲਤ ਖ਼ਸਤਾ ਹੈ ਇੱਥੋਂ ਦੇ ਸਕੂਲਾਂ ਦੀ ਦੇਖਭਾਲ ਸਹੀ ਤਰੀਕੇ ਨਹੀਂ ਕੀਤੀ ਜਾ ਰਹੀ ਅਤੇ ਇੱਥੋਂ ਦੇ ਟੀਚਰ ਵੀ ਪੂਰੇ ਨਹੀਂ ਹਨ ਸਕੂਲਾਂ ਵਿੱਚ ਅਤੇ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਬਹੁਤ ਜ਼ਿਆਦਾ ਹੈ ਆਬਾਦੀ ਦਿਨੋ ਦਿਨ ਵੱਧ ਰਹੀ ਹੈ ਜਿਸ ਕਾਰਨ ਮੋਹਾਲੀ ਜ਼ਿਲ੍ਹੇ ਵਿੱਚ ਬਾਹਰੋਂ ਲੋਕ ਆ ਕੇ ਰਹਿ ਰਹੇ ਹਨ ਅਤੇ ਉਰੇ ਦਾ ਰੁਜ਼ਗਾਰ ਬਹੁਤ ਘੱਟ ਹੈ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਵਸਨੀਕ ਲੋਕਾਂ ਨੂੰ ਰੁਜ਼ਗਾਰ ਦੀ ਬਹੁਤ ਕਮੀ ਹੈ